ਮੇਰੇ ਸ਼ਹਿਰ ਦੇ ਲਾਗੇ ਅਨੰਦਪੁਰ ਸਾਹਿਬ ਹੈ ਜਿੱਥੇ ਕਿ ਅਪ੍ਰੈਲ ਮਹੀਨੇ ਵਿੱਚ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਪਰ ਉਦੋਂ ਦਾ ਮੌਸਮ ਗਰਮੀ ਦਾ ਹੁੰਦਾ ਹੈ ਇੱਕ ਦਸੰਬਰ ਵਿੱਚ ਸਭਾ ਵੀ ਮਨਾਈ ਜਾਂਦੀ ਹੈ ਜਿਸ ਦਾ ਮੌਸਮ ਸਰਦੀ ਵਾਲਾ ਹੁੰਦਾ ਹੈ